ਸਤਿ ਸ਼੍ਰੀ ਅਕਾਲ ਭਾਅ ਜੀ ਕਿਆ ਹਾਲ ਚਾਲ ਹੈ ਹੋਰ ਕਿੱਦਾਂ ਘਰ ਪਰਿਵਾਰ ਸੁੱਖ ਸ਼ਾਂਤੀ ਭਾਅ ਜੀ ਮੈਂ ਹਰਨੇਕ ਸਿੰਘ ਬੋਲਦਾ ਨਵਾਂ ਸ਼ਹਿਰ ਤੋਂ ਭਾਅ ਜੀ ਨਾ ਸਾਡੇ ਨਾ ਘਰੇ ਐਕਚੁਅਲੀ ਰਿਸ਼ਤੇਦਾਰ ਆਏ ਵੇ ਸੀ ਅਸੀਂ ਸੋਚਿਆ ਵੀ ਅੱਜ ਰੋਟੀ ਔਨਲਾਇਨ ਔਡਰ ਕਰੀ ਜਾਵੇ ਅਤੇ ਤਾਂ ਕਰ ਤੁਹਾਨੂੰ ਹ ਤੁਹਾਡੀ ਯਾਦ ਆਈ ਵੀ ਅਸੀਂ ਸੋਚਿਆ ਆਪਣਾ ਬੰਦਾ ਹੈਗਾ ਵੀ ਉੱਥੇ ਤੁਹਾਨੂੰ ਫ਼ੋਨ ਕੀਤਾ ਜਾਵੇ ਫਿਰ ਔਡਰ ਕੀਤਾ ਜਾਵੇ ਸਾਡਾ ਭਾਅ ਜੀ ਯਾਰ ਔਡਰ ਲਿਖ ਲਿਓ ਇੱਕ ਹੈਗਾ ਭਾਅ ਜੀ ਦਾਲ ਫਰਾਈ ਦਾਲ ਮੱਖਣੀ ਮਿਕਸ ਵੈਜ ਆਲੂ ਮਟਰ ਮਟਰ ਪਨੀਰ ਸ਼ਾਹੀ ਪਨੀਰ ਕੜਾਹੀ ਪਨੀਰ ਪਨੀਰ ਭੁਰਜੀ ਅਤੇ ਦਹੀਂ ਰਾਇਤਾ ਐਡ ਕਰ ਦਿਓ ਚਾਵਲ ਐਡ ਕਰ ਦਿਓ ਅਤੇ ਬਾਕੀ ਰੋਟੀ ਐਡ ਕਰ ਦਿਓ ਵੀਹ ਪੱਚੀ ਤਾਂ ਤੰਦੂਰ ਦੀਆਂ ਰੋਟੀਆਂ ਲਾਹ ਦਿਓ ਬਾਕੀ ਦੂਜੀ ਰੋਟੀ ਲਾਹ ਦਿਓ ਤਵੇ ਵਾਲੀ ਰੋਟੀ ਲਾਹ ਦਿਓ ਲੱਛਾ ਪਰਾਂਠਾ ਭੇਜ ਦਿਓ ਚਾਰ ਪੰਜ ਆਲੂ ਪਰੋਂਠਾ ਭੇਜ ਦਿਓ ਅਤੇ ਬਾਕੀ ਹਾਊਸ ਨੰਬਰ ਭਾਅ ਜੀ ਇੱਕ ਸੌ ਇੱਕ ਨੰਬਰ ਮਕਾਨ ਹੈ ਭੇਜ ਦਿਓ ਬਾਕੀ ਭਾਅ ਜੀ ਹੋਰ ਭਾਅ ਜੀ ਪੇਮੈਂਟ ਦੱਸ ਦਿਓ ਕਿੱਦਾਂ ਕਰਨੀ ਹੈ ਕੈਸ਼ ਕਰਨੀ ਆ ਉਹ ਵੀ ਕਰ ਦੇਵਾਂਗੇ ਔਨਲਾਇਨ ਕਰਨੀ ਔਨਲਾਇਨ ਕਰ ਦੇਵਾਂਗੇ ਬਹੁ ਬਹੁ ਧੰਨਵਾਦ ਭਾਅ ਜੀ